ਹੈਲੋ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਜੀ ਸਾਡੇ ਵਧੀਆ ਜੀ ਅੱਛਾ ਜੀ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਭਾਅ ਜੀ ਬਹੁਤ ਵਧੀਆ ਸਾਧਨ ਆ ਅਤੇ ਬੜੀ ਵਧੀਆ ਗੱਲ ਹੈ ਤੁਸੀਂ ਇਥੋਂ ਛੱਡ ਕੇ ਆਪਣੇ ਯੂ ਪੀ ਤੋਂ ਅਤੇ ਇੱਥੇ ਆ ਗਏ ਜੇ ਪੰਜਾਬ 'ਚ ਅੰਮ੍ਰਿਤਸਰ ਦੇ ਵਸਨੀਕ ਬਣ ਗਏ ਜੀ ਏ ਇਹ ਤਾਂ ਹਰੇਕ ਪਿੰਡ ਨੂੰ ਹਰੇਕ ਸ਼ਹਿਰ ਨੂੰ ਜਾਣ ਵਾਲੀਆਂ ਬੱਸਾਂ ਮਿਲਦੀਆਂ ਤੁਸੀਂ ਚੰਡੀਗੜ੍ਹ ਜਾਣਾ ਕੋਈ ਪ੍ਰੋਬਲਮ ਨਹੀਂ ਗੀ ਚੌਵੀ ਘੰਟੇ ਸਰਵਿਸ ਚਲਦੀ ਚੰਡੀਗੜ੍ਹ ਦੀ ਦਿੱਲੀ ਦੀ ਰਾਜਸਥਾਨ ਗੰਗਾਨਗਰ ਨੂੰ ਜਾਣਾ ਹੋਵੇ ਤਾਂ ਵੀ ਆਪਾਂ ਨੂੰ ਚੌਵੀ ਘੰਟੇ ਬੱਸਾਂ ਮਿਲ ਜਾਂਦੀਆਂ ਅਤੇ ਕੋਈ ਪ੍ਰੋਬਲਮ ਨਹੀਂ ਹੈਗੀ ਬੱਸਾਂ ਦੀ ਅਤੇ ਦਿਨ ਰਾਤ ਬੱਸਾਂ ਮਿਲਦੀਆਂ ਆਂ ਅਤੇ ਅੰਮ੍ਰਿਤਸਰ ਦੇ ਵਿੱਚ ਸਟੋਪੇਜ ਵਧੀਆ ਵਾ ਬੱਸ ਸਟੈਂਡ ਵੀ ਬਹੁਤ ਸੋਹਣਾ ਬਣਿਆ ਵਾ ਅਤੇ ਜੇ ਲੋਕਲ ਵੀ ਜਾਣਾ ਹੋਵੇ ਤਾਂ ਆਪਾਂ ਨੂੰ ਲੋਕਲ ਬੱਸਾਂ ਹੈਗੀਆਂ ਇੱਥੋਂ ਮਿੰਨੀ ਬੱਸਾਂ ਚੱਲਦੀਆਂ ਇੱਥੋਂ ਹਰੇਕ ਘੰਟੇ ਨੂੰ ਛੋਟੀਆਂ ਛੋਟੇ ਕਸਬਿਆਂ ਲਈ ਹਾਂਜੀ ਚੱਲਦੀਆਂ ਆਪਾਂ ਜੇ ਕੋਈ ਪ੍ਰੋਬਲਮ ਨਹੀਂ ਇੱਥੇ ਹੈਗੀ ਅਤੇ ਬਸ ਵਧੀਆ ਚੱਲਦਾ ਹਾਂਜੀ ਹਾਂਜੀ ਲੋਕਲ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਜਾਣਾ ਹੋਵੇ ਕਿਤੇ ਦਰਸ਼ਨਾਂ ਲਈ ਜਾਣਾ ਦਰਬਾਰ ਸਾਹਿਬ ਜਾਣਾ ਦੁਰਗਿਆਨਾ ਮੰਦਰ ਸਾਹਿਬ ਜਾਣਾ ਜਾਂ ਰਾਮਦੇਵ ਜੀ ਜਾਣਾ ਵਾ ਤਾਂ ਇੱਥੇ ਆਟੋ ਦੇ ਫੈਸਲਿਟੀ ਬੜੀ ਵਧੀਆ ਵਾ ਮੈਟਰੋ ਚੱਲਦੀ ਆ ਅੰਮ੍ਰਿਤਸਰ ਦੇ ਵਿੱਚ ਬੱਸ ਜਿਹੜੀ ਇੰਡੀਆ ਗੇਟ ਤੋਂ ਲੈ ਕੇ ਅਤੇ ਗੋਲਡਨ ਗੇਟ ਤੱਕ ਚੱਲਦੀ ਆ ਉੱਧਰੋਂ ਆਪਣੇ ਇੱਧਰ ਚੱਲਦੀ ਬਟਾਲਾ ਰੋਡ ਨੂੰ ਵੀ ਚੱਲਦੀ ਆ ਮੈਟਰੋ ਦੀ ਸਰਵਿਸ ਬਹੁਤ ਵਧੀਆ ਚੱਲਦੀ ਆ ਹਾਂਜੀ ਹਾਂਜੀ ਹਾਂਜੀ ਇੱਥੋਂ ਟੈਕਸੀਆਂ ਔਨਲਾਈਨ ਬੁੱਕ ਹੁੰਦੀਆਂ ਵਾ ਬਾਕੀ ਟੈਕਸੀ ਸਟੈਂਡ ਵੀ ਅੰਮ੍ਰਿਤਸਰ 'ਚ ਬਣੇ ਆ ਉਹਨਾਂ ਉੱਪਰ ਸਾਰੀਆਂ ਚੱਲਦੀਆਂ ਟੈਕਸੀਆਂ ਵੀ ਇੱਥੇ ਜੀ ਅਤੇ ਟ੍ਰੇਨ ਵੀ ਚੱਲਦੀ ਆ ਟ੍ਰੇਨ ਵੀ ਆਪਾਂ ਨੂੰ ਹਰੇਕ ਚੰਡੀਗੜ੍ਹ ਨੂੰ ਟ੍ਰੇਨ ਚੱਲਦੀ ਹੈ ਜੇ ਤੁਸੀਂ ਟ੍ਰੇਨ 'ਤੇ ਜਾਣਾ ਪਸੰਦ ਕਰਦੇ ਆਵਾਜਾਈ ਦਾ ਸਾਧਨ ਦਿੱਲੀ ਨੂੰ ਹਾਂਜੀ ਭੱਟੀ ਨੂੰ ਹਾਂ ਠੀਕ ਹੈ ਸਰ ਓਕੇ ਸਰ